ਪੰਜਾਬੀ ਭਾਸ਼ਾ ਦੀ ਵਰਤੋਂ ਸਥਾਨਿਕ ਆਰਥਿਕਤਾ ਵਿੱਚ ਕੁਝ ਇਸ ਤਰ੍ਹਾਂ ਕੀਤੀ ਜਾਂਦੀ ਆ ਜਿਵੇਂ ਕਿ ਵਪਾਰ ਦੇ ਮੁੱਲ ਨੂੰ ਵੱਧ ਤੋਂ ਵੱਧ ਕਰਨਾ ਸੰਭਵ ਹੈ ਵਪਾਰ ਦੀ ਸਾਰਥਿਕਤਾ ਦੁਨੀਆਂ ਦੇ ਬਹੁਤ ਸਾਰੇ ਖੇਤਰਾਂ ਵਿੱਚ ਜਿਵੇਂ ਖੇਤਰਾਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਕੇ ਸਿੰਗਲ ਗਲੋਬਲ ਮਾਰਕੀਟ ਦੀ ਸਿਰਜਣਾ ਕਰਦੀ ਹੈ ਵਪਾਰ ਅਤੇ ਬਾਕੀ ਜੋ ਕਿ ਵਣਜ ਹੈ ਇਹ ਯਕੀਨੀ ਬਣਾਉਣ ਦਾ ਜਿਵੇਂ ਕਿ ਇੰਚਾਰਜ ਹੈ ਕਿ ਵਸਤੂਆਂ ਆਪਣੇ ਉਤਪਾਦਨ ਦੇ ਬਿੰਦੂ ਤੋਂ ਆਪਣੇ ਗਾਹਕਾਂ ਦੇ ਤੱਕ ਸੰਚਾਰੂ ਅਤੇ ਨਿਰੰਤਰ ਚੱਲਦੀਆਂ ਹਨ ਜਾਂ ਨਹੀਂ ਜਾਂ ਫਿਰ ਵਣਜ ਦਾ ਕੁਸ਼ਨ ਸੰਚਾਲਨ ਸੰਚਾਲਨ ਹੁੰਦਾ ਜਿਹੜਾ ਕੀਮਤਾਂ ਨੂੰ ਬਰਾਬਰ ਬਣਾਉਂਦਾ ਹੈ ਬਾਕੀ ਜਿਵੇਂ ਉਤਪਾਦਾਂ ਦੇ ਸਿਰਜਣਾ ਨੇ ਜੋਖਮ ਦੇ ਤੱਤਾਂ ਨੂੰ ਘਟਾ ਦਿੱਤਾ ਅਤੇ ਵਪਾਰੀਆਂ ਨੂੰ ਅਣਚਾਹੇ ਖੇਤਰ ਦੇ ਲਈ ਉਤਸ਼ਾਹਿਤ ਕੀਤਾ ਹੈ